ਸਕੂਲਾਂ ਅਤੇ ਕਾਲਜਾਂ ਵਿੱਚ ਸਾਇੰਟਿਸਟ ਪ੍ਰੋਜੈਕਟ ਅਤੇ ਟੀਚਰ ਬਣਾਉਣ ਲਈ ਕਹਿੰਦੇ ਸਨ ਤਦ ਅਸੀਂ ਘਰ ਵਿੱਚ ਅਸੀਂ ਸੁਬਤ ਕਢਾਈ ਜਾਂ ਜਾਂ ਚੂੜੀਆਂ ਲੈ ਕੇ ਆਉਂਦੇ ਸਨ ਜਦੋਂ ਅਸੀਂ ਬਣਾਉਦੇ ਹਾਂ ਤਦ ਸਾਡੇ ਸਾਡੇ ਸਕੂਲ ਦੀਆਂ ਪੋਸਟਾਂ ਸਭ ਨੂੰ ਪਸੰਦ ਆਉਂਦੀਆਂ ਸਨ ਅਤੇ ਸਭ ਲੋਕ ਇਸਨੂੰ ਦੂਰੋਂ ਦੂਰੋਂ ਦੇਖਣ ਆਉਂਦੇ ਹਨ ਜਿਸ ਨੂੰ ਵੀ ਪਸੰਦ ਆ ਜਾਵੇ ਉਹ ਇਸਨੂੰ ਘਰ ਲੈ ਕੇ ਚਲੇ ਜਾਂਦੇ ਸਨ ਇਸ ਦੀ ਇਸ ਦੀ ਮਿਹਨਤ ਨਾਲ ਸਾਨੂੰ ਬਹੁਤ ਹੀ ਇਨਾਮ ਮਿਲਦੇ ਸਨ ਸਕੂਲ ਅਤੇ ਕਾਲਜ ਨੂੰ ਦੇ ਬਹੁਤ ਹੀ ਮਿਹਨਤ ਨਾਲ ਬਣਾਉਂਦੇ ਸਨ ਇਸ ਵਿੱਚ ਟੀਚਰ ਬਹੁਤ ਹੀ ਖੁਸ਼ ਹੋ ਜਾਂਦੇ ਸਨ ਬੱਚੇ ਬਹੁਤ ਹੀ ਮਿਹਨਤ ਕਰਦੇ ਸਨ ਅਤੇ